ਹਾਂਜੀ ਜ਼ਰੂਰ ਸਕੂਲ ਦੇ ਫ਼ੰਕਸ਼ਨ ਦੇ ਵਿੱਚ ਬਹੁਤ ਵਾਰ ਹਿੱਸਾ ਲਿਆ ਹੈ ਜਿਹਦੇ ਵਿੱਚ ਇੱਕ ਵਾਰ ਗਿੱਧਾ ਕੀਤਾ ਸਕਿੱਟ ਕੀਤੀ ਡਾਂਸ ਕੀਤਾ ਤਾਂ ਇਨ੍ਹਾਂ ਦੇ ਵਿੱਚ ਮੇਰਾ ਤਜ਼ਰਬਾ ਬਹੁਤ ਵਧੀਆ ਰਿਹਾ ਜਦੋਂ ਗਿੱਧਾ ਕੀਤਾ ਉਸ ਸਮੇਂ ਬਹੁਤ ਸਾਰੀਆਂ ਬੋਲੀਆਂ ਸਿੱਖਣ ਨੂੰ ਮਿਲੀਆਂ ਅਤੇ ਆਪਦੇ ਜਿਹੜਾ ਆਪਣਾ ਗਿੱਧਾ ਵਾਲੇ ਲੋਕ ਗੀਤ ਆ ਉਹਦੇ ਬਾਰੇ ਬਹੁਤ ਕੁਛ ਜਾਨਣ ਨੂੰ ਮਿਲਿਆ ਜਿਹੜਾ ਕਿ ਸ਼ਾਇਦ ਉਂਝ ਨਹੀਂ ਸੀ ਜਾਣ ਸਕਣਾ ਫੇਰ ਜਦੋਂ ਡਾਂਸ ਕੀਤਾ ਡਾਂਸ ਦੇ ਵਿੱਚ ਵੀ ਜਦੋਂ ਸਕੂਲ ਵਾਲੀਆਂ ਸਾਰੀਆਂ ਅਸੀਂ ਕੁੜੀਆਂ ਨੇ ਰਲ ਕੇ ਡਾਂਸ ਕੀਤਾ ਤਾਂ ਉਹਦੇ ਵਿੱਚ ਬਹੁਤ ਹੀ ਵਧੀਆ ਲੱਗਿਆ ਜਦੋਂ ਪਹਿਲਾਂ ਅਸੀਂ ਉਹਦੀ ਤਿਆਰੀ ਕਰਦੇ ਰਹੇ ਤਾਂ ਉਸ ਤੋਂ ਬਾਅਦ ਜਦੋਂ ਮਤਲਬ ਪ੍ਰਫੋਰਮੈਂਸ ਕੀਤੀ ਤਾਂ ਉਦੋਂ ਵੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਤਜ਼ਰਬਾ ਰਿਹਾ ਡਾਂਸ ਬਾਰੇ ਹੋਰ ਵੀ ਪਤਾ ਲੱਗਿਆ ਜਿਹੜਾ ਕਿ ਸ਼ਾਇਦ ਉਂਝ ਘਰੇ ਆਪਾਂ ਨੂੰ ਨਹੀਂ ਪਤਾ ਲੱਗਣਾ ਸੀ ਅਤੇ ਮੇਰਾ ਤਜ਼ਰਬਾ ਉਸ ਸਮੇਂ ਬਹੁਤ ਵਧੀਆ ਰਿਹਾ ਸੀ ਅਤੇ ਸਕੂਲ ਦੇ ਵਿੱਚ ਜਿਹੜੇ ਵੀ ਕੋਈ ਫ਼ੰਕਸ਼ਨ ਹੋਏ ਹੈ ਉਨ੍ਹਾਂ ਵਿੱਚ ਪਾਰਟੀਸੀਪੇਟ ਕਰਨਾ ਅਤੇ ਫਿਰ ਉਨ੍ਹਾਂ ਦੇ ਵਿੱਚ ਵਧੀਆ ਤਰੀਕੇ ਨਾਲ ਆਪਦੀ ਤਿਆਰੀ ਕਰਨੀ ਇਹ ਤਜ਼ਰਬਾ ਬਹੁਤ ਵਧੀਆ ਸੀ ਸਹੇਲੀਆਂ ਦੇ ਨਾਲ ਰਲ ਕੇ ਨੱਚਣਾ ਗਾਉਣਾ ਇੱਕ ਬਹੁਤ ਵਧੀਆ ਗੱਲ ਹੈ ਅਤੇ ਉਹ ਦਿਨ ਹੁਣ ਵੀ ਬਹੁਤ ਯਾਦ ਆਉਂਦੇ ਅਤੇ ਉਨ੍ਹਾਂ ਦਿਨਾਂ ਦਾ ਤਜ਼ਰਬਾ ਬਹੁਤ ਵਧੀਆ ਰਿਹਾ ਸੀ ਵਾਧੂ ਸਿੱਖਣ ਨੂੰ ਮਿਲਿਆ ਜਿਹੜਾ ਕਿ ਆਪਣੇ ਲਈ ਉਸ ਸਮੇਂ ਜ਼ਰੂਰੀ ਹੁੰਦਾ ਜਦੋਂ ਕਿ ਆਪਾਂ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਦੇ ਤੌਰ 'ਤੇ ਪੜ੍ਹਦੇ ਹਾਂ ਤਾਂ ਆਪਣਾ ਜਿਹੜਾ ਹੈਗਾ ਵਾ ਕੌਨਫੀਡੈਂਸ ਲੈਵਲ ਉਹ ਅੱਗੇ ਨਾਲੋਂ ਵੀ ਜ਼ਿਆਦਾ ਵੱਧਦਾ ਵਾ ਜਿਹੜੀ ਕਿ ਇੱਕ ਸਟੂਡੈਂਟ ਦੇ ਤੌਰ 'ਤੇ ਆਪਣੇ ਲਈ ਬਹੁਤ ਵਧੀਆ ਗੱਲ ਆ